ਮੈਂ ਘੁੰਮਣ ਦੀ ਬਹੁਤ ਸ਼ੌਕੀਨ ਹਾਂ ਮੈਨੂੰ ਘੁੰਮਣਾ ਬਹੁਤ ਪਸੰਦ ਹੈ ਆਖਰ ਕਿਹਨੂੰ ਘੁੰਮਦਾ ਪਸੰਦ ਨਹੀਂ ਹੁੰਦਾ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਗਰਮੀ ਦੇ ਮੌਸਮ ਵਿੱਚ ਘੁੰਮਣ ਜਾਣਾ ਬਹੁਤ ਵਧੀਆ ਲੱਗਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਜੂਨ ਜੁਲਾਈ ਦੇ ਮਹੀਨਿਆਂ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਪੈਂਦੀ ਹੈ ਇੰਨੀ ਗਰਮੀ ਪੈਂਦੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਜਾਂਦੀ ਇਸ ਲਈ ਮੈਨੂੰ ਗਰਮੀ ਦੇ ਮੌਸਮ ਵਿੱਚ ਕਿਤੇ ਘੁੰਮਣ ਜਾਣਾ ਬਹੁਤ ਵਧੀਆ ਲੱਗਦਾ ਉਹ ਵੀ ਐਸੀ ਜਗ੍ਹਾ ਜਾਣਾ ਜਿੱਥੇ ਦਾ ਟੈਂਪਰੇਚਰ ਥੋੜ੍ਹਾ ਕੂਲ ਹੋਵੇ ਹਜੇ ਪਿਛਲੇ ਸਾਲ ਹੀ ਮੈਂ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ ਮਾਤਾ ਪਿਤਾ ਨਾਲ ਸ਼ਿਮਲਾ ਜਾਣ ਦਾ ਪਲੈਨ ਬਣਾਇਆ ਸੀ ਫਿਰ ਅਸੀਂ ਜਦੋਂ ਸ਼ਿਮਲਾ ਗਏ ਤਾਂ ਉੱਥੋਂ ਦਾ ਟੈਂਪਰੇਚਰ ਬਹੁਤ ਹੀ ਠੰਡਾ ਸੀ ਅਤੇ ਮੈਨੂੰ ਉੱਥੋਂ ਦਾ ਕਲਚਰ ਉੱਥੋਂ ਦਾ ਟ੍ਰਾਡੀਸ਼ਨ ਬਹੁਤ ਹੀ ਵਧੀਆ ਲੱਗਾ ਜਦ ਮੈਂ ਸ਼ਿਮਲੇ ਗਈ ਅਤੇ ਮੈਂ ਕਈ ਚੀਜ਼ਾਂ ਦਾ ਸਾਹਮਣਾ ਕੀਤਾ ਉੱਥੋਂ ਦੀਆਂ ਸੜਕਾਂ ਬਹੁਤ ਹੀ ਪਤਲੀਆਂ ਹਨ ਉੱਥੇ ਦੇ ਪਹਾੜ ਬਹੁਤ ਹੀ ਆਕਰਸ਼ਿਤ ਹਨ ਅਤੇ ਉੱਥੇ ਜਾ ਕੇ ਜਦੋਂ ਅਸੀਂ ਨੇਚਰ ਨਾਲ ਇੰਟਰੈਕਟ ਕਰਦੇ ਹਾਂ ਤਾਂ ਸਾਡੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਇਸ ਲਈ ਮੈਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਘੁੰਮਣ ਜਾਣਾ ਬਹੁਤ ਹੀ ਵਧੀਆ ਲੱਗਦਾ ਹੈ